ਖੇਡਾਂ ਪੇਂਡੂ ਲੋਕਾਂ ਦੇ ਜੀਵਨ ਵਿੱਚ ਬਹੁਤ ਵੱਡੀ ਮਹੱਤਵਪੂਰਨ ਭੂਮਿਕਾ ਰੱਖਦੀਆਂ ਹਨ ਖੇਡਾਂ ਖੇਡਣ ਨਾਲ ਇੱਕ ਤਾਂ ਆਪਸੀ ਪਿਆਰ ਬਣਿਆ ਰਹਿੰਦਾ ਅਤੇ ਖੇਡਾਂ ਖੇਡਣ ਨਾਲ ਖਿਡਾਰੀਆਂ ਦਾ ਜੋ ਸਰੀਰਿਕ ਵਿਕਾਸ ਆ ਉਹ ਚੰਗੇ ਤਰੀਕੇ ਨਾਲ ਹੁੰਦਾ ਹੈ ਸਿਹਤ ਸ ਵਧੀਆ ਰਹਿੰਦੀ ਹੈ ਅਤੇ ਜੋ ਇਹ ਖੇਡਾਂ ਖੇਡਣ ਨਾਲ ਖਿਡਾਰੀਆਂ ਨੂੰ ਨਸ਼ੇ ਤੋਂ ਦੂਰ ਰੱਖਿਆ ਜਾ ਸਕਦਾ ਹੈ ਆਪਸੀ ਭਾਈਚਾਰਾ ਕਾਇਮ ਰਹਿੰਦਾ ਏ ਅਤੇ ਇਕੱਠੇ ਰਹਿਣ ਦੀ ਜ ਜੋ ਹੈ ਮੇਲ ਮਿਲਾਪ ਵਧਿਆ ਰਹਿੰਦਾ